ਸਤਿ ਸ਼੍ਰੀ ਅਕਾਲ ਮੇਰਾ ਨਾਮ ਪੱਲਵੀ ਹੈ ਔਰ ਮੈਂ ਪਠਾਨਕੋਟ ਤੋਂ ਬੋਲਿਆ ਕਰਦੀ ਹਾਂ ਜਿੱਦਾਂ ਕਿ ਅਸੀਂ ਸਵੀਗੀ ਐਪ ਤੋਂ ਫ਼ੋਨ ਕੀਤਾ ਸੀ ਕਿ ਅੱਜ ਮੇਰੇ ਛੋਟੇ ਬ੍ਰਦਰ ਦਾ ਜਨਮਦਿਨ ਹੈ ਅਸੀਂ ਘਰ ਵਿੱਚ ਸ਼ਾਮ ਨੂੰ ਪਾਰਟੀ ਰੱਖੀ ਹੋਈ ਆ ਅਤੇ ਮੈਂ ਸਵੀਗੀ ਐਪ ਤੋਂ ਕੁਝ ਮੰਗਵਾਉਣਾ ਚਾਹੁੰਦੀ ਹਾਂ ਕੁਝ ਔਰਡਰ ਕਰਨਾ ਚਾਹੁੰਦੀ ਹਾਂ ਮੇਰੇ ਔਰਡਰ ਜਿਵੇਂ ਕਿ ਨਿਮਨਲਿਖਤ ਅਨੁਸਾਰ ਹਨ ਜਿਵੇਂ ਕਿ ਤੀਹ ਪੀਸ ਸਪਿੰਗ ਰੋਲ ਚਾਲੀ ਪੀਸ ਮੋਮੋਜ ਤਿੰਨ ਪਨੀਰ ਰੋਲ ਅਤੇ ਚਾਰ ਪਲੇਟਾਂ ਸਮੋਸੇ ਦੀਆਂ ਅੱਗੇ ਅਸੀਂ ਡਿਨਰ ਵਿੱਚ ਵੀ ਕੁਝ ਮੰਗਵਾਉਣਾ ਚਾਹੁੰਦੇ ਹਾਂ ਤਾਂ ਜੋ ਮਹਿਮਾਨਾਂ ਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਤੰਗੀ ਨਾ ਹੋ ਸਕੇ ਜਿਵੇਂ ਕਿ ਦਾਲ ਮੱਖਣੀ ਪੁਲਾਓ ਮਿਕਸ ਸਬਜ਼ੀ ਆਦਿ ਚੀਜ਼ਾਂ ਸਾਡੇ ਔਰਡਰ ਅਨੁਸਾਰ ਭੇਜ ਦਿੱਤੀਆਂ ਜਾਣ ਅਤੇ ਮੈਂ ਸ਼ਾਮ ਨੂੰ ਪਾਰਟੀ ਸਮੇਤ ਕੁਝ ਤਬਦੀਲੀ ਵੀ ਕੀਤੀ ਹੈ ਅਤੇ ਇਸ ਤਬਦੀਲੀ ਅਨੁਸਾਰ ਤੁਸੀਂ ਡਿਸਪੋਜਿਸ ਗਲਾਸ ਜਿਵੇਂ ਕਿ ਵੀਹ ਡਿਸਪੋਜਿਸ ਗਲਾਸ ਵੀਹ ਪਲੇਟਾਂ ਡਿਸਪੋਜਿਸ ਪਲੇਟਾਂ ਵੀਹ ਡਿਸਪੋਜ਼ਲ ਚਮਚ ਆਦਿ ਜਿਹੜੇ ਆ ਭੇਜ ਦਿੱਤੇ ਜਾਣ ਤਾਂ ਜੋ ਮਹਿਮਾਨਾਂ ਨੂੰ ਕਿਸੇ ਪ੍ਰਕਾਰ ਦੀ ਵੀ ਮੁਸ਼ਕਿਲ ਜਿਹੜੀ ਆ ਉਹ ਨਾ ਆਵੇ ਔਰ ਇਸ ਡਿਸਪੋਜ਼ਲ ਬਿੱਲਾਂ ਦਾ ਅਤੇ ਸਾਰੇ ਔਰਡਰ ਅਨੁਸਾਰ ਬਣਦਾ ਬਿੱਲ ਸਾਨੂੰ ਦੱਸਿਆ ਜਾਵੇ ਤਾਂ ਜੋ ਮੈਂ ਸਮੇਂ ਅਨੁਸਾਰ ਇਹਨਾਂ ਦੀ ਪੇਮੈਂਟ ਜਿਹੜੀ ਆ ਉਹ ਕਰ ਸਕਾਂ ਔਰਡਰ ਨਿਮਨਲਿਖਤ ਅਨੁਸਾਰ ਉਸ ਸਮੇਂ ਸਿਰ ਭੇਜ ਦਿੱਤਾ ਜਾਵੇ ਤਾਂ ਜੋ ਸਾਨੂੰ ਵੀ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਵੇ ਔਰ ਤੁਸੀਂ ਵੀ ਸਾਨੂੰ ਬਣਦਾ ਬਿੱਲ ਦੱਸ ਦਿੱਤਾ ਜਾਵੇ ਤਾਂ ਜੋ ਤੁਹਾਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਮੁਸ਼ਕਿਲ ਨਾ ਆਵੇ